ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਕੁਛ ਕੀਤਾ ਜਾਂਦਾ ਹੈ ਜਿਵੇਂ ਕਿ ਪਿੱਛੇ ਜਿਹੇ ਜਦੋਂ ਬਾਦਲ ਸਰਕਾਰ ਸੀ ਪੰਜਾਬ ਵਿੱਚ ਲੜਕੀਆਂ ਨੂੰ ਜਿਹੜੇ ਸਕੂਲ ਵਾਲੀਆਂ ਸੀ ਉਹਨਾਂ ਨੂੰ ਸਾਈਕਲ ਵੰਡੇ ਗਏ ਅਖਿਲੇਸ਼ ਸਰਕਾਰ ਨੇ ਇਹ ਕਿਹਾ ਕਿ ਅਸੀਂ ਅਗਰ ਜਿੱਤਾਂਗੇ ਤਾਂ ਉੱਥੇ ਲੈਪਟੋਪ ਦੇਵਾਂਗੇ ਹੋਰ ਵੀ ਕਈ ਸਰਕਾਰਾਂ ਨੇ ਜਿਹੜੇ ਇਹੋ ਜਿਹੇ ਵਾਅਦੇ ਕਰਦੀਆਂ ਨੇ ਦੇਖੋ ਹਰ ਹਾਲ ਦੇ ਵਿੱਚ ਫ਼ਾਇਦਾ ਤਾਂ ਇਹਨਾਂ ਵਿੱਚ ਬਹੁਤ ਹੈ ਕਿਉਂਕਿ ਕਈ ਹੁੰਦੇ ਆ ਜਿਹੜੇ ਇਹ ਚੀਜ਼ਾਂ ਨੂੰ ਨਹੀਂ ਅਫੋਰਡ ਕਰਾ ਸਕਦੇ ਬੱਚਿਆਂ ਨੂੰ ਇਕ ਸਾਈਕਲ ਲੈਪਟੋਪ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜੀ ਵੱਡੀ ਜ਼ਰੂਰਤ ਦੀ ਚੀਜ਼ ਬਣ ਗਈ ਹੈ ਜੋ ਤੁਹਾਨੂੰ ਕਿਤਾਬਾਂ 'ਚ ਨਹੀਂ ਪੜ੍ਹਨ ਨੂੰ ਮਿਲਦਾ ਜੋ ਮਟੀਰੀਅਲ ਨਹੀਂ ਲੱਭਦਾ ਉਹ ਤੁਸੀਂ ਸਰਚ ਕਰਕੇ ਨੈਟ ਤੋਂ ਦੇਖ ਸਕਦੇ ਹੋ ਵੈਸੇ ਵੀ ਬੱਚੇ ਨੂੰ ਇੱਕ ਤਰ੍ਹਾਂ ਦਾ ਕਹਿ ਲਓ ਕਿ ਇਹ ਜਿਹੜੇ ਵਜ਼ੀਫੇ ਲੱਗਦੇ ਨੇ ਇਹਨਾਂ ਨਾਲ ਇੱਕ ਬੱਚੇ ਦੇ ਮਨ ਨੂੰ ਵੀ ਹੁੰਦਾ ਹੈ ਕਿ ਮੈਂ ਕੁਛ ਕਰ ਰਿਹਾ ਅਤੇ ਮੈਨੂੰ ਕੁਛ ਮਿਲ ਰਿਹਾ ਫਿਰ ਦੂਸਰੇ ਪਾਸੇ ਦੇਖੋ ਗਰੀਬ ਮਾਤਾ ਪਿਤਾ ਨੂੰ ਵੀ ਹੁੰਦਾ ਦੇਖੋ ਸਾਡਾ ਬੱਚਾ ਜਾਵੇਗਾ ਕਿਤੇ ਪੜ੍ਹੇਗਾ ਉਹਨੂੰ ਕੁਛ ਮਿਲੇਗਾ ਕੱਲ੍ਹ ਨੂੰ ਵੱਡਾ ਹੋ ਕੇ ਬੱਚੇ ਦੇ ਮਨ ਦੇ ਵਿੱਚ ਵੀ ਰਹਿੰਦਾ ਹੈ ਕਿ ਮੈਨੂੰ ਸ਼ਾਇਦ ਕਿਤੇ ਨਾ ਕਿਤੇ ਕਹਿ ਲਓ ਕਿ ਭਾਰਤ ਦੀ ਗਰੀਬੀ ਹੈਗੀ ਐ ਕਿ ਚੀਜ਼ਾਂ ਕਈ ਵਾਰੀ ਕਹਿ ਲਓ ਕਿ ਇਹ ਚੀਜ਼ਾਂ ਵੀ ਸਾਨੂੰ ਆਪਣੇ ਵੱਲ ਖਿੱਚਦੀਆਂ ਨੇ ਜਿਵੇਂ ਕਿ ਕਹਿ ਲਓ ਕੀ ਗਰੀਬ ਪਰਿਵਾਰ ਦੇ ਕਿਸੇ ਨੂੰ ਲੈਪਟੋਪ ਮਿਲੇ ਉਹ ਉਹਦੇ ਤੋਂ ਹੀ ਕਿੰਨੇ ਤਰ੍ਹਾਂ ਦੀ ਪੜ੍ਹਾਈ ਕਰਕੇ ਅਤੇ ਕਿੱਥੇ ਪਹੁੰਚ ਸਕਦਾ ਅਤੇ ਕਹਿ ਲਓ ਕਿ ਇੱਕ ਯੁੱਗ ਦਾ ਬਦਲਾਅ ਹੈ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੁੰਦੇ ਨੇ ਜਦੋਂ ਉਹਨਾਂ ਨੂੰ ਸਕੋਲਰਸ਼ਿਪ ਜਾਂ ਕੁਛ ਵੀ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦਾ ਭਲਾ ਹੀ ਕਰਦੀਆਂ ਨੇ